ਹਾਂਜੀ ਬੜੀਆ ਜੀ ਬੜੀਆ ਕੰਚਨ ਤੁਸੀਂ ਸੁਣਾਓ ਠੀਕ ਠਾਕ ਹਾਂਜੀ ਹਾਂਜੀ ਓਕੇ ਕਿਸ ਟੋਪਿਕ 'ਤੇ ਲਿਖਣ ਦੀ ਸੋਚ ਰਹੇ ਹੋ ਕੋਵਿਡ 'ਤੇ

ਕੋਈ ਗੱਲ ਨਹੀਂ ਆਪਾਂ ਕਰ ਲੈਂਦੇ ਹਾਂ ਕੋਵਿਡ ਵਿੱਚ ਸਭ ਤੋਂ ਪਹਿਲਾਂ ਤਾਂ ਆਪਾਂ ਦੇਖੋ ਐਸ ਟਾਈਪ ਦਾ ਮਾਹੌਲ ਐਸ ਟਾਈਪ ਦਾ ਜੋ ਟਾਈਮ ਹੈ ਆਪਣੇ 'ਤੇ ਕਦੀ ਆਇਆ ਹੀ ਨਹੀਂ ਸੀ ਕਿ ਐਵੇਂ ਸਭ ਅੰਦਰ ਹੀ ਮਤਲਬ ਆਪਣੇ ਘਰਾਂ ਵਿੱਚ ਲੋਕ ਹੀ ਹੋ ਗਏ ਸੀਗੇ ਨਾ ਤਾਂ ਇਹ ਚੀਜ਼ ਸਭ ਤੋਂ ਜ਼ਿਆਦਾ ਉਹ ਸੀ ਅਜੀਬ ਹੈ ਨਾ ਕਿ ਦੇਖੋ ਨੇਚਰ ਨੂੰ ਆਪਦੇ ਆਪ ਨੂੰ ਰੀਪੈਨਿਸ਼ ਕਰਨ ਲਈ ਟਾਈਮ ਮਿਲਿਆ ਮੇਰਾ ਤਾਂ ਮਤਲਬ ਪੁਆਇੰਟ ਆਫ ਵਿਯੂ ਇਹੀ ਹੈ ਕਿ ਦੇਖੋ ਇਹਦੇ ਨੈਗੇਟਿਵ ਐਸਪੈਕਟ ਤਾਂ ਚਲੋ ਸੀਗੇ ਲੇਕਿਨ ਇਹਦੇ ਪੋਜੀਟਿਵ ਵੀ ਬਹੁਤ ਜ਼ਿਆਦਾ ਇਫੈਕਟ ਹੋਏ ਆ ਨੇਚਰ 'ਤੇ ਹੈ ਨਾ ਆਲ ਉਵਰ ਰੀਵਰਸ ਵਗੈਰਾ ਸਭ ਜੋ ਵੀ ਹੈ ਲੋਕਾਂ ਦੇ ਜੋ ਮੈਂਟਲ ਹੂੰ ਹੂੰ ਹਾਂਜੀ ਠੀਕ ਹੈ ਪੋਜੀਟਿਵ ਵੀ ਹਾਂ ਬਿਲਕੁਲ ਹੂੰ ਮੋਰਓਵਰ ਇਹ ਆਉਣ ਵਾਲੀ ਜਨਰੇਸ਼ਨ ਵਾਸਤੇ ਵੀ ਹੈਲਪਫੁਲ ਹੋਏਗੀ ਨਾ ਕਿ ਉਹਨਾਂ ਨੂੰ ਵੀ ਪਤਾ ਲੱਗੇਗਾ ਕਿ ਕਿਸ ਟਾਈਪ ਦਾ ਇੱਕ ਹੈ ਨਾ ਐਪੀਡੈਮਿਕ ਵਗੈਰਾ ਕਿਉਂਕਿ ਇਹਦੇ ਬਾਰੇ ਪਤਾ ਹੋਣਾ ਚਾਹੀਦਾ ਆਪਣੀ ਨੈਕਸਟ ਜਨਰੇਸ਼ਨ ਨੂੰ ਵੀ ਪਤਾ ਹੋਣਾ ਚਾਹੀਦਾ ਕਿਉਂਕਿ ਉਹ ਚੀਜ਼ਾਂ ਉਹਨਾਂ ਨੇ ਫੇਸ ਨਹੀਂ ਕੀਤੀਆਂ ਜੋ ਆਪਾਂ ਕੀਤੀਆਂ ਡੀਯੂਰਿੰਗ ਦੈਟ ਪੀਰੀਅਡ ਹੂੰ ਹਾਂਜੀ ਬਿਲਕੁਲ ਬਿਲਕੁਲ ਠੀਕ ਹੈ ਚਲੋ ਜਦੋਂ ਤੁਸੀਂ ਸਟਾਰਟ ਕਰੋ ਤਾਂ ਦੱਸਣਾ ਮੈਂ ਆਪਣੇ ਵਿਊਸ ਵੀ ਭੇਜ ਦੂੰਗੀ ਤੁਹਾਨੂੰ ਠੀਕ ਹੈ ਹੈਲਪ ਹੋ ਜੂਗੀ ਓਕੇ ਥੈਂਕ ਯੂ ਥੈਂਕ ਯੂ